ਘੋੜਾ ਵਿਅਕਤੀ ਦਾ ਬਹੁਤ ਹੀ ਵਧੀਆ ਦੋਸਤ ਸਾਬਤ ਹੁੰਦਾ ਹੈ ਜੇਕਰ ਤੁਸੀਂ ਉਸ ਨਾਲ਼ ਪਿਆਰ ਨਾਲ਼ ਬੰਧਨ ਬਣਾ ਬਣਾ ਲੈਂਦੇ ਹੋ ਘੋੜੇ ਨੂੰ ਆਪਣੇ ਹੱਥ ਨਾਲ਼ ਖਵਾਉਣਾ ਉਸਦੀ ਸਾਫ਼ ਸਫ਼ਾਈ ਕਰਨੀ ਉਸਨੂੰ ਨਹਿਲਾਉਣਾ ਅਤੇ ਉਸਦਾ ਧਿਆਨ ਰੱਖਣਾ ਇਸ ਨਾਲ਼ ਘੋੜੇ ਦਾ ਤੁਹਾਡੇ ਪ੍ਰਤੀ ਪਿਆਰ ਉਤਪੰਨ ਹੋ ਜਾਂਦਾ ਹੈ ਅਤੇ ਘੋੜ ਸਵਾਰੀ ਕਰਦੇ ਸਮੇਂ ਤੁਹਾਨੂੰ ਹਮੇਸ਼ਾ ਡਰ ਰਹਿਤ ਰਹਿਣਾ ਚਾਹੀਦਾ ਹੈ ਅਸੀਂ ਆਪਣੇ ਘੋੜ ਸਵਾਰੀ ਵਿੱਚ ਵਿਸ਼ਵਾਸ ਦੀ ਵਿਸ਼ੇਸ਼ ਭੂਮਿਕਾ ਇਸ ਲਈ ਹੈ ਕਿਉਂਕਿ ਅਗਰ ਜੇ ਡਰ ਨਾਲ਼ ਅਸੀਂ ਘੋੜ ਸਵਾਰੀ ਕਰਦੇ ਹਾਂ ਤਾਂ ਡਿੱਗਣ ਦਾ ਖ਼ਤਰਾ ਰਹਿੰਦਾ ਹੈ ਪਰ ਜੇ ਤੁਸੀਂ ਘੋੜੇ ਨਾਲ਼ ਪਿਆਰ ਪਾ ਲੈਂਦੇ ਹੋ ਤਾਂ ਉਹ ਤੁਹਾਡੀ ਸੁਰੱਖਿਆ ਦਾ ਆਪ ਬਹੁਤ ਧਿਆਨ ਰੱਖਦਾ ਹੈ ਇਸ ਲਈ ਘੋੜੇ ਨਾਲ਼ ਬੰਧਨ ਸਿਰਫ਼ ਪਿਆਰ ਦਾ ਬਣਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਜੇ ਤੁਸੀਂ ਉਸ ਨੂੰ ਡਰ ਜਾ ਡਰਾਵੇ ਨਾਲ਼ ਘੋੜ ਸਵਾਰੀ ਕਰਦੇ ਹੋ ਤਾਂ ਇਹ ਵਧੀਆ ਬੰਧਨ ਨਹੀਂ ਬਣਦਾ ਹੈ